ਤਰਨਤਾਰਨ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਕਈ ਇਤਿਹਾਸਿਕ ਸਥਾਨ ਹਨ ਜੋ ਕਿ ਬਹੁਤ ਲੋਕ ਦੂਰੋਂ ਦੂਰੋਂ ਇਹਨਾਂ ਦੇ ਦਰਸ਼ਨ ਕਰਨ ਲਈ ਆਪਣੀ ਆਸਥਾ ਦੀ ਪੂਰਤੀ ਕਰਨ ਲਈ ਇੱਥੇ ਆਉਂਦੇ ਹਨ ਇਹਨਾਂ ਸਾਰੇ ਇਤਿਹਾਸਿਕ ਸਥਾਨਾਂ ਵਿੱਚੋਂ ਸ਼੍ਰੀ ਦਰਬਾਰ ਸਾਹਿਬ ਹੈ ਜੋ ਕਿ ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਉਸਾਰਿਆ ਸੀ ਇਹ ਤਰਨਤਾਰਨ ਵਿੱਚ ਸਥਿਤ ਹੈ ਇਸ ਵਿੱਚ ਬਹੁਤ ਵੱਡਾ ਸਰੋਵਰ ਹੈ ਇਹ ਸਰੋਵਰ ਸਾਰੇ ਇਤਿਹਾਸਿਕ ਸਰੋਵਰਾਂ ਨਾਲੋਂ ਵੱਡਾ ਹੈ ਇਸ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਦੁੱਖ ਦੂਰ ਹੁੰਦੇ ਹਨ ਇਸ ਅਸਥਾਨ 'ਤੇ ਹਰ ਮਹੀਨੇ ਚੋਦੇ ਅਤੇ ਮੱਸਿਆ ਲੱਗਦੀ ਹੈ ਇਸ ਸਥਾਨ 'ਤੇ ਹਰ ਧਰਮ ਦਾ ਵਿਅਕਤੀ ਦਰਸ਼ਨ ਕਰਨ ਲਈ ਆ ਸਕਦਾ ਹੈ ਲੋਕ ਆਪਣੀ ਮਨ ਦੀ ਸ਼ਾਂਤੀ ਲਈ ਦਰਬਾਰ ਸਾਹਿਬ ਨਮਸਤਕ ਕਰਦੇ ਹਨ ਸ਼੍ਰੀ ਦਰਬਾਰ ਸਾਹਿਬ ਵਿੱਚ ਹੀ ਇੱਕ ਅਜਾਇਬ ਘਰ ਬਣਿਆ ਹੋਇਆ ਹੈ ਇਹ ਅਜਾਇਬ ਘਰ ਧਾਰਮਿਕ ਨਾਲ ਸਬੰਧਿਤ ਹੈ ਇਸ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਸ਼ਹੀਦਾਂ ਸਿੰਘਾਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਇਹਨਾਂ ਤਸਵੀਰਾਂ ਦੇ ਨਾਲ ਹੀ ਇਹਨਾਂ ਦਾ ਸਾਰਾ ਇਤਿਹਾਸ ਦਿੱਤਾ ਗਿਆ ਹੈ ਦਰਬਾਰ ਸਾਹਿਬ ਹਰ ਵਿਅਕਤੀ ਮਰਿਆਦਾ ਅਨੁਸਾਰ ਆਪਣੀ ਮਰਜ਼ੀ ਨਾਲ ਦਰਸ਼ਨ ਕਰ ਸਕਦਾ ਹੈ ਲੋਕ ਆਪਣਾ ਔਖਾ ਸਮਾਂ ਬਿਤਾਉਣ ਲਈ ਗੁਰੂ ਦੀ ਸ਼ਰਨ ਲੈਂਦੇ ਹਨ